ਪੰਜਾਬ ਵਿੱਚ ਸਿੱਖਿਆ ਦੀ ਬਹੁਤ ਯੋਗਦਾਨ ਹੈ ਜਿਵੇਂ ਕਿ ਹੁਣ ਆਪਾਂ ਅੱਜ ਕੱਲ੍ਹ ਪੜ੍ਹੇ ਲਿਖੇ ਹਾਂ ਤਾਂ ਅੱਗੇ ਆਪਾਂ ਆਪਣੇ ਬੱਚਿਆਂ ਨੂੰ ਪੜਾਵਾਂਗੇ ਆਪਣੇ ਪੇਰੈਂਟਸ ਪੜ੍ਹੇ ਲਿਖੇ ਸੀ ਤਾਂ ਆਪਾਂ ਨੂੰ ਉਹਨਾਂ ਨੇ ਅੱਗੇ ਪੜ੍ਹਾਈਆਂ ਕਰਾਤੀਆਂ ਜਿਵੇਂ ਕਿ ਹੁਣ ਮੈਨੇ ਐੱਮ ਏ ਐੱਮ ਫਿਲ ਪੀ ਐੱਜ ਡੀ ਕੀਤੀ ਹੋਈ ਹੈ ਜੇ ਮੇਰੇ ਮਾਂ ਬਾਪ ਪੜ੍ਹੇ ਲਿਖੇ ਸੀ ਤਾਂ ਉਹਨਾਂ ਨੇ ਮੈਨੂੰ ਅੱਗੇ ਪੜ੍ਹਾ ਤਾ ਤਾਂ ਮੈਂ ਅੱਗੇ ਆਪਣੇ ਬੱਚਿਆਂ ਨੂੰ ਪੜਾਉਂਗੀ ਠੀਕ ਹੈ ਕਿ ਹੁਣ ਜਿਵੇਂ ਮੇਰਾ ਮਨ ਹੈ ਕਿ ਮੈਂ ਆਪਣੇ ਬੱਚੇ ਨੂੰ ਆਈ ਐੱਸ ਪੀ ਸੀ ਐੱਸ ਕਰਾਵਾਂ ਤਾਂ ਬੜੇ ਔਫਿਸਰ ਬਣਾਵਾਂ ਇਹਦੇ ਲਈ ਸਿੱਖਿਆ ਦੀ ਬਹੁਤ ਜ਼ਿਆਦਾ ਇਮਪੋਰਟੈਂਸ ਹੈ ਕਿਵੇਂ ਕਿ ਜਿਵੇਂ ਅੱਜ ਕੱਲ੍ਹ ਜੇ ਬੱਚੇ ਨੂੰ ਕੋਈ ਟੋਪਿਕ ਨਹੀਂ ਆਉਂਦਾ ਤਾਂ ਅੱਜ ਕੱਲ੍ਹ ਔਨਲਾਈਨ ਕਾਫ਼ੀ ਜ਼ਿਆਦਾ ਵੀਡੀਓਸਜ਼ ਆਉਂਦੀਆਂ ਨੇ ਲੈਕਚਰਸ ਆਉਂਦੇ ਨੇ ਸੈਮੀਨਾਰਸ ਆਉਂਦੇ ਨੇ ਕੋਨਫਰੈਂਸਿਸ ਆਉਂਦੀਆਂ ਨੇ ਜਿਵੇਂ ਕਿ ਹੁਣ ਆਪਾਂ ਕੋਈ ਯੂਟਿਊਬ 'ਤੇ ਕੋਈ ਵੀ ਲੈਕਚਰ ਡਾਊਨਲੋਡ ਕਰ ਲੈਂਦੇ ਹਾਂ ਤਾਂ ਉਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਆਪਾਂ ਕਿਵੇਂ ਲੈਕਚਰਸ ਕਿਵੇਂ ਸਟੇਜਿਸ ਤਿਆਰ ਕਰਨਾ ਪਹਿਲਾਂ ਕੀ ਉਹਦਾ ਪ੍ਰੋਸੈਸ ਹੋਏਗਾ ਠੀਕ ਹੈ ਉਸ ਤੋਂ ਬਾਅਦ ਜਿਵੇਂ ਆਪਾਂ ਗੂਗਲ 'ਤੇ ਜਿਵੇਂ ਅੱਜ ਕੱਲ੍ਹ ਕਰੋਨਾ ਆਇਆ ਸੀ ਉਹਦੇ ਨਾਲ ਆਪਾਂ ਔਨਲਾਈਨ ਕਲਾਸਿਸ ਲਗਾਉਣ ਲੱਗ ਗਏ ਗੂਗਲ ਕਲਾਸ ਰੂਮ 'ਤੇ ਕਲਾਸਿਸ ਲੱਗਣ ਲੱਗ ਗਈਆਂ ਉਹ ਮਤਲਬ ਜਦੋਂ ਆਪਾਂ ਲੈਕਚਰ ਦਿੰਦੇ ਹਾਂ ਤਾਂ ਉਹਦੇ ਨਾਲ ਇੱਕ ਨਾਲ ਕਾਫ਼ੀ ਬੱਚੇ ਕਨੈਕਟ ਹੋ ਕੇ ਆਪਾਂ ਉਹਨਾਂ ਨੂੰ ਲੈਕਚਰਸ ਦੇ ਸਕਦੇ ਹਾਂ ਇਸ ਤਰ੍ਹਾਂ ਹੁਣ ਆਪਾਂ ਕਹਿੰਦੇ ਹਾਂ ਕਿ ਐਜੂਕੇਸ਼ਨ ਦਾ ਬਹੁਤ ਜ਼ਿਆਦਾ ਸਕੋਪ ਹੈ ਇਹ ਐਜੂਕੇਸ਼ਨ ਨਾਲ ਕਿ ਆਪਾਂ ਨੂੰ ਕੋਈ ਵੀ ਚੀਜ਼ ਕੰਮ ਕਰਨ ਦਾ ਸਲੀਕਾ ਆਉਂਦਾ ਗੱਲਬਾਤ ਕਰਨ ਦਾ ਸਲੀਕਾ ਆਉਂਦਾ ਜੇ ਹੁਣ ਆਪਾਂ ਕੋਈ ਕੇਸ ਮਤਲਬ ਜੇ ਕਿਸੇ ਨਾਲ ਆਪਣਾ ਕੋਈ ਲੜਾਈ ਝਗੜਾ ਹੋ ਜਾਏ ਜਾਂ ਕੋਈ ਵੀ ਕੋਈ ਡਿਸਪਿਊਟਸ ਹੋ ਜਾਏ ਆਪਾਂ ਕੋਰਸ ਕੋਰਟ 'ਚ ਜਾਣਾ ਹੈ ਤਾਂ ਆਪਣਾ ਪੜ੍ਹਿਆ ਲਿਖਿਆ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਆਪਾਂ ਪੜ੍ਹ ਲਿਖ ਕੇ ਕੋਈ ਮੈਟਰ ਨੂੰ ਸੁਲਝਾ ਸਕਦੇ ਹਾਂ ਜੇ ਆਪਾਂ ਪੜ੍ਹੇ ਲਿਖੇ ਹੋਵਾਂਗੇ ਆਪਾਂ ਬਿਮਾਰ ਹੋਏ ਤਾਂ ਡਾਕਟਰ ਕੋਲ ਜਾ ਸਕਦੇ ਹਾਂ ਉਹਨਾਂ ਨੂੰ ਦੱਸ ਸਕਦੇ ਆਂ ਅਸੀਂ ਇਹ ਬਿਮਾਰ ਹਾਂ ਸਾਨੂੰ ਇਸ ਮੈਡੀਸਨ ਦੀ ਨੌਲੇਜ ਹੈ ਇਹ ਮੈਡੀਸਨ ਨਾਲ ਸਾਨੂੰ ਫਰਕ ਨਹੀਂ ਪਿਆ ਸਾਨੂੰ ਇਹ ਦਵਾਈ ਨਾਲ ਫਰਕ ਪੈ ਸਕਦਾ ਹੈ ਮਤਲਬ ਐਜੂਕੇਸ਼ਨ ਦਾ ਆਪਾਂ ਕਹਿ ਸਕਦੇ ਹਾਂ ਹਰ ਲੈਵਲ 'ਤੇ ਬਹੁਤ ਜ਼ਿਆਦਾ ਉਹਦੀ ਇਮਪੋਰਟੈਂਸ ਹੈ ਠੀਕ ਹੈ ਇਹਦੇ ਵਿੱਚ ਮੁੱਖ ਕਾਰਕ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਗੂਗਲ ਕਲਾਸ ਰੂਮਸ ਹੋਗਈਆਂ ਗੂਗਲ 'ਤੇ ਆਪਾਂ ਕੋਈ ਵੀ ਚੀਜ਼ ਹੈ ਉਹਨੂੰ ਸਰਚ ਕਰ ਸਕਦੇ ਹਾਂ ਕਿ ਇਹਦੇ ਕੀ ਬੈਨੀਫਿਟਸ ਨੇ ਕੀ ਇਹਦੇ ਨੈਗੇਟਿਵ ਹੈ ਕੀ ਇਹਦਾ ਪੋਜੀਟਿਵ ਹੈ ਮਤਲਬ ਆਪਾਂ ਦੇਖੋ ਜਦੋਂ ਆਪਾਂ ਕਿਸੇ ਚੀਜ਼ ਕੋਲ ਜਾਂਦੇ ਕੋ ਡੋਕਟਰ ਕੋਲ ਜਾਂਦੇ ਹਾਂ ਕਿਸੇ ਟੀਚਰ ਕੋਲ ਜਾਂਦੇ ਹਾਂ ਜੋ ਆਪਾਂ ਨੂੰ ਉਹਨਾਂ ਬਾਰੇ ਕੋਈ ਵਾਰੀ ਕੋਈ ਚੀਜ਼ ਬਾਰੇ ਦੱਸਦੇ ਹੈ ਤਾਂ ਆਪਾਂ ਹਰ ਇੱਕ ਚੀਜ਼ ਦੇ ਨੈਗੇੇਟਿਵ ਅਤੇ ਪੋਜੀਟਿਵ ਕਿੱਥੋਂ ਲੱਭਦੇ ਹਾਂ ਔਨਲਾਈਨ ਆਪਾਂ ਸਰਚ ਕਰਕੇ ਕਿਸੇ ਵੀ ਚੀਜ਼ ਦੀ ਆਪਾਂ ਕੋਈ ਬੈਨੀਫਿਟਸ ਨੇ ਨੈਗੇਟਿਵ ਪੁਆਇੰਟਸ ਨੇ ਸਾਰੀਆਂ ਚੀਜ਼ਾਂ ਆਪਾਂ ਦੇਖ ਸਕਦੇ ਹਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਜਿਹੜਾ ਬਹੁਤ ਜ਼ਿਆਦਾ ਸਕੋਪ ਹੈ